ਪੰਜਾਬੀ ਭਾਸ਼ਾ ਵਿੱਚ ਬਹੁਤ ਸਾਰੇ ਸ਼ਬਦ ਅਤੇ ਵਾਕੰਸ਼ ਹਨ ਜਿਹਨਾਂ ਵਿੱਚੋਂ ਮੇਰਾ ਮਨਪਸੰਦ ਵਾਕੰਸ਼ ਇਹ ਹੈ ਕਿ ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਚਾਨਣ ਹੋਇਆ ਜਿਸਦਾ ਭਾਵ ਇਹ ਹੈ ਕਿ ਜਦੋਂ ਗੁਰੂ ਨਾਨਕ ਦੇਵ ਜੀ ਦਾ ਜਨਮ ਹੋਇਆ ਉਸ ਸਮੇਂ ਬੁਰਿਆ ਬੁਰਾਈ ਦਾ ਅੰਤ ਹੋ ਕੇ ਅੱਛਾਈ ਦੀ ਚਾਨ ਅੱਛਾਈ ਦਾ ਚਾਨਣ ਫੈਲਿਆ ਫੈਲ ਗਿਆ ਅਤੇ ਮੈਨੂੰ ਇਹ ਮੈਨੂੰ ਪੰਜਾਬੀ ਪੰਜਾਬ ਵਿੱਚ ਪੈਦਾ ਹੋਣ 'ਤੇ ਬਹੁਤ ਹੀ ਜ਼ਿਆਦਾ ਮਾਣ ਹੈ ਅਤੇ ਮੈਨੂੰ ਇਹ ਵੀ ਮਾਣ ਹੈ ਕਿ ਮੈਂ ਪੰਜਾਬ ਵਿੱਚ ਰਹਿ ਕੇ ਪੰਜਾਬੀ ਬੋਲਦੀ ਹਾਂ ਅਤੇ ਮੇਰੀ ਮਨਪਸੰਦ ਭਾਸ਼ਾ ਵੀ ਪੰਜਾਬੀ ਹੀ ਹੈ